ਹੈਲੋ ਹਾਂਜੀ ਕੌਣ ਜੀ ਹਾਂਜੀ ਹਾਂਜੀ ਸਬਜ਼ੀਆਂ ਵਾਲੀ ਦੁਕਾਨ ਤੋਂ ਬੋਲਦੇ ਹਾਂ ਜੀ ਕਿਹੜੀਆਂ ਕਿਹੜੀਆਂ ਸਬਜ਼ੀਆਂ ਚਾਹੀਦੀਆਂ ਤੁਹਾਨੂੰ ਹਾਂਜੀ ਅੱਛਾ ਜੀ ਮਨਪ੍ਰੀਤ ਬੋਲਦੇ ਹੋ ਠੀਕ ਹੈ ਜੀ ਸਾਡੇ ਕੋਲ ਸਾਰੀਆਂ ਸਬਜ਼ੀਆਂ ਤਾਜ਼ੀਆਂ ਬਾਈ ਜੀ ਸਾਡੇ ਆਪਣੇ ਲੱਗੀ ਵੀ ਹੈ ਬਗੀਚੀ ਭਿੰਡੀ ਮਿਲ ਜੂਗੀ ਜੀ ਕੱਦੂ ਮਿਲਜੂਗਾ ਜੀ ਤੋਰੀ ਮਿਲਜੂਗੀ ਜੀ ਸਲਾਦ 'ਚ ਤੁਹਾਨੂੰ ਖੀਰੇ ਤਰਾਂ ਟਮਾਟਰ ਪਿਆਜ ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਜੀ ਜੇ ਤੁਹਾਨੂੰ ਐਕਸਟਰਾ ਕੋਈ ਸਬਜ਼ੀ ਦੀ ਹੋਰ ਲੋੜ ਪਊਗੀ ਜਰੂਰਤ ਪਊਗੀ ਸਾਡੇ ਕੋਲੇ ਤਾਜ਼ੀਆਂ ਸਬਜ਼ੀਆਂ ਅਸੀਂ ਇਹਨਾਂ ਨੂੰ ਸੁਬਾਹ ਤੋੜਦੇ ਹਾਂ ਜੀ ਫਿਰ ਇਹਨਾਂ ਨੂੰ ਧੋ ਕੇ ਸਾਫ਼ ਪਾਣੀ ਨਾਲ ਧੋ ਕੇ ਫਰੈਸ਼ ਕਰਕੇ ਰੱਖਦੇ ਹਾਂ ਜੀ ਉੱਤੋਂ ਕੱਪੜੇ ਨਾਲ ਢੱਕ ਕੇ ਤੁਹਾਨੂੰ ਜਿੰਨੀ ਜਿੰਨੀ ਲੋੜ ਹੋਊਗੀ ਜੀ ਤੁਸੀਂ ਸਾਨੂੰ ਲਖਾ ਨੋਟ ਕਰਾ ਦਿਓ ਉੰਨੀ ਉੰਨੀ ਅਤੇ ਜੇ ਕੋਈ ਐਕਸਟਰਾ ਇਹਨਾਂ ਤੋਂ ਬਿਨਾਂ ਚਾਹੀਦੀ ਹੈ ਤਾਂ ਉਹ ਦੱਸ ਦਿਓ ਜੀ ਠੀਕ ਹੈ ਜੀ ਸਲਾਦ 'ਚ ਆ ਗਿਆ ਖੀਰਾ ਆ ਗਿਆ ਜੀ ਟਮਾਟਰ ਆ ਗਿਆ ਪਿਆਜ ਆ ਗਿਆ ਤਰਾਂ ਆ ਗਈਆਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਲਾਦ 'ਚ ਮਿਲ ਜਾਣਗੀਆਂ ਜੀ ਅਤੇ ਜੇ ਤੁਸੀਂ ਸੁੱਕੀ ਸਬਜ਼ੀ ਵੈਜੀਟੇਬਲ ਬਣਾਉਣੀ ਹੈ ਜੀ ਭਿੰਡੀ ਹੈ ਜੀ ਅਰਬੀ ਹੈ ਜੀ ਮਿਕਸ ਸਬਜ਼ੀ ਕੱਦੂ ਹੈ ਜੀ ਪੇਠਾ ਹੈ ਜੀ ਠੀਕ ਹੈ ਨਾ ਇਹ ਸਾਰੀਆਂ ਸਬਜ਼ੀਆਂ ਸਾਡੇ ਕੋਲ ਫਰੈਸ਼ ਮਿਲ ਜਾਣੀਆਂ ਜੀ ਬਿਲਕੁਲ ਤਾਜ਼ੀਆਂ ਜਦੋਂ ਤੁਸੀਂ ਲੈਣ ਆਓਗੇ ਅਸੀਂ ਉਦੋਂ ਤੋੜ ਕੇ ਵੀ ਮੌਕੇ 'ਤੇ ਦੇ ਸਕਦੇ ਹਾਂ ਰੇਟ ਸਾਰੀਆਂ ਸਬਜ਼ੀਆਂ ਦਾ ਅਲੱਗ ਅਲੱਗ ਹੈ ਜੀ ਤੁਹਾਨੂੰ ਜਾਇਜ਼ ਜਾਇਜ਼ ਰੇਟ ਲਗਾਵਾਂਗੇ ਬਾਜ਼ਾਰ ਨਾਲੋਂ ਸਸਤਾ ਲਗਾਵਾਂਗੇ ਜੀ ਪਹਿਲਾਂ ਵੀ ਸਾਡੀ ਸਬਜ਼ੀ ਤੁਹਾਡੇ ਪਿੰਡ ਜਾਂਦੀ ਹੈ ਜੀ ਹਾਂਜੀ ਬਸ ਤੁਸੀਂ ਨਾਂ ਅਤੇ ਮੋਬਾਇਲ ਨੰਬਰ ਲਿਖਾ ਦਿਓ ਜੀ ਹਾਂਜੀ ਠੀਕ ਹਾਂ ਨਹੀਂ ਜਦੋਂ ਤੁਹਾਨੂੰ ਲੋੜ ਆ ਸਾਨੂੰ ਸਮਾਂ ਦੱਸ ਦਿਓ ਜੀ ਵੀ ਕੱਲ੍ਹ ਨੂੰ ਲੋੜ ਹੈ ਸ਼ਾਮ ਨੂੰ ਲੋੜ ਹੈ ਜੇ ਤੁਹਾਨੂੰ ਨੌਂ ਵਜੇ ਲੋੜ ਹੈ ਤਾਂ ਤੁਸੀਂ ਸਾਨੂੰ ਸੱਤ ਵਜੇ ਮੈਸੇਜ ਕਰ ਦਿਓ ਅਸੀਂ ਜਿੰਨੀ ਸਬਜ਼ੀ ਦੀ ਤੁਹਾਨੂੰ ਭਿੰਡੀ ਜਿੰਨੀ ਕਿਲੋ ਚਾਹੀਦੀ ਹੋਊਗੀ ਜੀ ਉਹ ਦੱਸ ਦਿਓ ਠੀਕ ਹੈ ਪੇਠਾ ਜਿੰਨੇ ਕਿੱਲੋ ਚਾਹੀਦਾ ਹੋਊ ਉਹ ਦੱਸ ਦਿਓ ਜੀ ਕੱਦੂ ਚਾਹੀਦਾ ਉਹ ਦੱਸ ਦਿਓ ਜੀ ਤਰਾਂ ਚਾਹੀਦੀਆਂ ਉਹ ਦੱਸ ਦਿਓ ਜੀ ਤੋਰੀਆਂ ਚਾਹੀਦੀਆਂ ਉਹ ਦੱਸ ਦਿਓ ਜੀ ਸਲਾਦ 'ਚ ਖੀਰਾ ਟਮਾਟਰ ਪਿਆਜ ਜਿਹੜੀ ਆਈਟਮ ਤੁਹਾਨੂੰ ਚਾਹੀਦੀ ਉਹ ਸਾਨੂੰ ਨੋਟ ਕਰਾ ਦਿਓ ਜਿੰਨੀ ਜਿੰਨੀ ਚਾਹੀਦੀ ਹੋਈ ਜੀ ਜੇ ਪਤਾ ਕੀ ਗੱਲ ਆ ਬਾਈ ਜੀ ਇਹ ਗਾਹਕ ਜ਼ਿਆਦਾ ਹੁੰਦੇ ਆ ਤੁਸੀਂ ਘੰਟਾ ਪਹਿਲਾਂ ਸਮੇਂ ਤੋਂ ਘੰਟਾ ਪਹਿਲਾਂ ਤੁਸੀਂ ਸਾਨੂੰ ਨੋਟ ਕਰਾ ਦਿਓ ਫਿਰ ਉਹ ਸਬਜ਼ੀ ਅਸੀਂ ਜਿਹੜੀ ਤੁਸੀਂ ਲੈ ਕੇ ਜਾਣੀ ਉਹ ਅਸੀਂ ਸ਼ਹਿਰ ਨਹੀਂ ਲੈ ਕੇ ਜਾਂਦੇ ਜੀ ਵੈਸੇ ਤਾਂ ਅਸੀਂ ਸਬਜ਼ੀ ਤੋੜ ਕੇ ਸ਼ਹਿਰ ਵੇਚ ਆਉਂਦੇ ਹਾਂ ਜਿੰਨੀ ਸਬਜ਼ੀ ਤੁਹਾਨੂੰ ਲੋੜ ਹੋਊਗੀ ਤੁਹਾਡੀ ਅਸੀਂ ਜਿੰਨੇ ਕਿਲੋ ਚਾਹੀਦੀ ਹੋਊਗੀ ਐਕਸਟਰਾ ਰੱਖ ਦਿਆਂਗੇ ਜੀ ਠੀਕ ਹੈ ਠੀਕ ਹੈ ਜੀ ਓਕੇ ਓਕੇ ਓਕੇ ਬਾਈ ਜੀ ਓਕੇ ਮਨਪ੍ਰੀਤ ਜੀ